ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਨਹੀਂ ਜੀ ਨਹੀਂ ਆਪਣੇ ਵੱਲੋਂ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਟਰੈਫਿਕ ਨੂੰ ਕੰਟਰੋਲ ਕਰਨ ਲਈ ਸਾਰਾ ਕੁਛ ਕੰਟਰੋਲ ਅਸੀਂ ਆਪਣੀ ਹੱਦ ਤੱਕ ਤਾਂ ਕਰ ਰਹੇ ਹਾਂ ਅਵੇਅਰ ਕਰ ਰਹੇ ਹਾਂ ਲੋਕਾਂ ਨੂੰ ਬਾਕੀ ਲੋਕ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਕੋਸ਼ਿਸ਼ ਜਾਰੀ ਹੈ ਓਕੇ ਜੀ ਹਾਂਜੀ ਹਾਂਜੀ ਜ਼ਰੂਰ ਤੁਹਾਡੀ ਕੰਪਲੇਂਟ ਨੂੰ ਅਸੀਂ ਕਰਾਂਗੇ ਵੈਸੇ ਪਹਿਲੇ ਵੀ ਲਾ ਰੱਖੀ ਹੈ ਪੁਲਿਸ ਬਹੁਤ ਜ਼ਿਆਦਾ ਬਾਕੀ ਹੋਰ ਵੀ ਆਪਾਂ ਕਰ ਦਾਂਗੇ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਜੀ ਹਾਂਜੀ ਹਾਂਜੀ ਕੋਸ਼ਿਸ਼ ਤੁਹਾਨੂੰ ਪਤਾ ਹੈ ਪੁਲਿਸ ਹਰ ਚੌਂਕ 'ਚ ਲੱਗੀ ਹੋਈ ਹੈ ਬਾਕੀ ਅੱਗੇ ਤੋਂ ਹੋਰ ਕੋਸ਼ਿਸ਼ ਕਰਦੇ ਹਾਂ ਅੱਗੇ ਵਧਾਉਂਦੇ ਹਾਂ ਪੁਲਿਸ ਫੋਰਸ ਅਤੇ ਹਰ ਚੌਂਕ 'ਤੇ ਲੱਗੀ ਹੋਏਗੀ ਪੁਲਿਸ ਵੇਖੀ ਮਿਲੇਗੀ ਤੁਹਾਨੂੰ ਟਰੈਫਿਕ ਪੁਲਿਸ ਕੰਟਰੋਲ ਕਰਨ ਦੀ ਕੋਸ਼ਿਸ਼ ਪੂਰੀ ਪੂਰੀ ਹੈ ਬਾਕੀ ਬਹੁਤ ਧੰਨਵਾਦ ਤੁਹਾਡਾ ਜੇ ਕੀਤਾ ਅਵੇਅਰ ਸਾਨੂੰ ਓਕੇ ਤੁਸੀਂ ਉਹ ਰੋਡ ਤੇ ਚੋਰੀ ਦੀ ਗੱਲ ਕਰਦੇ ਹੋ ਹਾਂਜੀ ਠੀਕ ਰਾਈਟ ਹੈ ਤੁਸੀਂ ਸਹੀ ਗੱਲ ਕਰ ਰਹੇ ਹੋ ਜੀ ਇਹਦੇ 'ਤੇ ਵੀ ਧਿਆਨ ਦਿਆਂਗੇ ਓਕੇ ਜੀ ਜ਼ਰੂਰ ਜ਼ਰੂਰ ਬਹੁਤ ਜਲਦ ਇਹ ਤੁਹਾਨੂੰ ਕੰਟਰੋਲ ਵੇਖਣ ਨੂੰ ਮਿਲੇਗਾ ਬਾਕੀ ਜਿਹੜੀ ਪਰੇਸ਼ਾਨੀ ਆ ਗਈ ਆ ਗਈ ਹੁਣ ਅੱਗੇ ਤੋਂ ਤੁਹਾਡਾ ਬਹੁਤ ਜ਼ਿਆਦਾ ਧਿਆਨ ਰੱਖਿਆ ਜਾਏਗਾ ਠੀਕ ਹੈ ਜੀ ਥੈਂਕ ਯੂ